ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੀ ਜਿਹੜੀ ਹੈਗੀ ਆ ਇੱਕ ਅਰਗੇਨੀਆ ਸਟੇਟ ਹੈ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਤਾਂ ਇਸ ਕਰਕੇ ਪੰਜਾਬ ਜਿਹੜੇ ਮੇਨ ਲੋਕਾਂ ਦਾ ਮੁੱਖ ਕਿੱਤਾ ਹੈ ਮੇਨ ਰੁਜ਼ਗਾਰ ਜਾਂ ਆਮਦਨ ਸਾਧਨ ਹੈ ਆਮਦਨ ਸਰੋਤ ਉਹ ਖੇਤੀਬਾੜੀ ਤੋਂ ਹੀ ਮੁੱਖ ਸ੍ਰੋਤ ਹੈ ਖੇਤੀਬਾੜੀ ਅਤੇ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਵਿੱਚ ਜਿਹੜੀ ਹੈਗੀ ਆ ਇੱਥੇ ਵੀ ਜਿਹੜਾ ਖੇਤੀਬਾੜੀ ਮੁੱਖ ਕਿੱਤਾ ਹੈ ਪਰ ਇਸ ਤੋਂ ਇਲਾਵਾ ਜਿਹੜਾ ਹੈ ਪਟਿਆਲੇ ਨੂੰ ਐਜੂਕੇਸ਼ਨ ਹੱਬ ਵੀ ਕਿਹਾ ਜਾਂਦਾ ਪਟਿਆਲੇ ਵਿੱਚ ਬਹੁਤ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਤਾਂ ਲੋਕਾਂ ਨੇ ਰੁਜ਼ਗਾਰ ਦੇ ਸਾਧਨਾਂ ਦੀ ਗੱਲ ਕਰੀਏ ਤਾਂ ਇੱਥੇ ਰੁਜ਼ਗਾਰ ਦੇ ਲਈ ਕਾਫੀ ਜ਼ਿਆਦਾ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ ਜਿਹੜੇ ਹੈ ਟੀਚਿੰਗ ਲਾਈਨ ਦੇ ਵਿੱਚ ਕਾਫੀ ਜ਼ਿਆਦਾ ਰੁਜ਼ਗਾਰ ਮਿਲਦਾ ਗਾ ਲੋਕਾਂ ਨੂੰ ਅਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਨੇ ਪੜ੍ਹਾਉਣ ਤੋਂ ਇਲਾਵਾ ਕਲਰਕ ਹੋ ਗਿਆ ਨੌਨ ਟੀਚਿੰਗ ਵਰਕ ਹੋ ਗਿਆ ਉਸ ਵਰਕ ਦੇ ਵਿੱਚ ਕਾਫੀ ਜ਼ਿਆਦਾ ਰੁਜ਼ਗਾਰ ਮਿਲਦਾ ਲੇਬਰ ਵਰਕ ਹੋ ਗਿਆ ਅਤੇ ਸੈਂਟਰ ਦੇ ਵਿੱਚ ਚੰਡੀਗੜ੍ਹ ਰੂਟ ਨੂੰ ਇਹ ਸੈਂਟਰ ਦੇ ਵਿੱਚ ਪੈਂਦਾ ਤਾਂ ਟਰਾਂਸਪੋਰਟੇਸ਼ਨ ਦੇ ਪੁਆਇੰਟ ਔਫ ਵਿਊ ਤੋਂ ਜਿਹੜਾ ਹੈ ਇੱਥੇ ਲੋਕਾਂ ਨੂੰ ਰੁਜ਼ਗਾਰ ਕਾਫੀ ਜ਼ਿਆਦਾ ਮਿਲਦਾ ਅਤੇ ਐਗਰੀਕਲਚਰ ਦਾ ਜਿਹੜਾ ਇੱਥੇ ਹੈ ਹੀ ਹੈ ਅਤੇ ਇੰਡਸਟਰੀਜ਼ ਵਗੈਰਾ ਇੱਥੇ ਇੰਨੀਆਂ ਜ਼ਿਆਦਾ ਨਹੀਂ ਹੈ ਬਟ ਜਿਹੜੀ ਹੈਗੀਆਂ ਆਪਣੀਆਂ ਮੇਨ ਤਾਂ ਇੱਥੇ ਐਜੂਕੇਸ਼ਨ ਜਿਹੜੀ ਹੈਗੀ ਹੱਬ ਆ ਕਈ ਯੂਨੀਵਰਸਿਟੀਆਂ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਇਸ ਪਟਿਆਲੇ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਹੈ ਰਾਜੀਵ ਗਾਂਧੀ ਲੋਅ ਯੂਨੀਵਰਸਿਟੀ ਇਸ ਪਟਿਆਲੇ ਵਿੱਚ ਥਾਪਰ ਯੂਨੀਵਰਸਿਟੀ ਹੈ ਤਿੰਨ ਤਾਂ ਮੇਨ ਮੇਨ ਯੂਨੀਵਰਸਿਟੀਆਂ ਹੀ ਇੱਥੇ ਨੇ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਹੋਰ ਮੇਨ ਕੋਲੇਜ ਜਿਹੜੇ ਹੈਗੇ ਨੇ ਮੋਤੀ ਕੋਲੇਜ ਹੈ ਆਪਣਾ ਮਹਿੰਦਰਾ ਕੋਲੇਜ ਹੈ ਖਾਲਸਾ ਕੋਲੇਜ ਹੈ ਇਹ ਮੇਨ ਕੋਲੇਜ ਨੇ ਜਾਂ ਬਿਕਰਮ ਅਦਿਆਈ ਜਿਹੜੀ ਕੋਲੇਜ ਹੈ ਕਮਰਸ ਦਾ ਕੋਲੇਜ ਹੈ ਪੰਜਾਬ ਦੇ ਵਿੱਚ ਜਿਹੜਾ ਫਿਜ਼ੀਕਲ ਕੋਲੇਜ ਹੈ ਪਟਿਆਲੇ ਵਿੱਚ ਹੀ ਹੈ ਤਾਂ ਉਸ ਪੁਆਇੰਟ ਤੋਂ ਵੀ ਜਿਹੜਾ ਇੱਥੇ ਕਾਫੀ ਜ਼ਿਆਦਾ ਜਿਹੜੇ ਹੈ ਐਜੂਕੇਸ਼ਨ ਇੰਸਟੀਟਿਊਸ਼ਨਸ ਹੋਣ ਕਰਕੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਅਤੇ ਦੂਰੋਂ ਨੇੜੇ ਜਿਹੜੀ ਹੈਗੇ ਨੇ ਕਾਫੀ ਲੋਕ ਇੱਥੇ ਰੁਜ਼ਗਾਰ ਦੇ ਲਈ ਐਜੂਕੇਸ਼ਨ ਮੇਨਲੀ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਰੁਜ਼ਗਾਰ ਲੈਣ ਦੇ ਲਈ ਇੱਥੇ ਆਉਂਦੇ ਨੇ ਤਾਂ ਮੇਨ ਜਿਹੜਾ ਹੈ ਇੱਥੋਂ ਦਾ ਮੰਨਿਆਂ ਜਾਂਦਾ ਉਹ ਐਜੂਕੇਸ਼ਨ ਹੱਬ ਦੇ ਪੁਆਇੰਟ ਔਫ ਤੋਂ ਹੀ ਮੰਨਿਆਂ ਜਾਂਦਾ ਬਾਕੀ ਆਪਣਾ ਟਰਾਂਸਪੋਰਟੇਸ਼ਨ ਹੋ ਗਿਆ ਜਾਂ ਐਗਰੀਕਲਚਰ ਹੋ ਗਿਆ ਜਾਂ ਛੋਟੇ ਮੋਟੀਆਂ ਇੰਡਸਟਰੀਜ਼ ਹੋਗੀਆਂ ਨੇ ਜਾਂ ਆਪਣੇ ਆ ਜਿਵੇਂ ਪੰਜਾਬੀ ਪਟਿਆਲੇ ਦੀ ਗੱਲ ਕਰੀ ਤਾਂ ਪਟਿਆਲੇ ਦੀ ਜੁੱਤੀ ਪਟਿਆਲੇ ਦੇ ਜਿਹੜਾ ਸੂਟ ਨੇ ਉਹ ਫੇਮਸ ਆ ਟੈਕਸਟਾਈਲ ਦੇ ਪੁਆਇੰਟ ਔਫ ਵਿਊ ਤੋਂ ਜਾਂ ਜਿਹੜੀ ਹੈਗੀ ਆ ਆਪਣੀ ਜੁੱਤੀਆਂ ਦੇ ਜਿਹੜੇ ਹੈ ਬਿਜ਼ਨਸ ਉਸ ਪੁਆਇੰਟ ਦੇ ਵਿੱਚ ਵੀ ਕਾਫੀ ਜ਼ਿਆਦਾ ਇੱਥੇ ਬਿਜ਼ਨਸ ਹੈ